ਪਸ਼ੂਆਂ ਤੋਂ ਫ਼ਸਲਾਂ ਦੀ ਰਾਖੀ ਲਈ ਅਸੀਂ ਜ਼ਿਆਦਾਤਰ ਲੋਹੇ ਦੀ ਤਾਰ ਦੀ ਵਾੜ ਕਰਦੇ ਹਾਂ ਜਿਸਨੂੰ ਕਿ ਫੈਂਸਿੰਗ ਕਹਿੰਦੇ ਹਨ ਆਮ ਤੌਰ 'ਤੇ ਖੇਤਾਂ ਦੇ ਵਿੱਚ ਜਾਨਵਰ ਗਊਆਂ ਸੂਰ ਸੂਰ ਵਰਗੇ ਜਾਨਵਰ ਆ ਕੇ ਫ਼ਸਲ ਖ਼ਰਾਬ ਕਰਦੇ ਹਨ ਅਤੇ ਕੁਝ ਛੋਟੇ ਜਾਨਵਰ ਜਿਵੇਂ ਕਿ ਕੁੱਤੇ ਬਿੱਲੀ ਵੀ ਨੁਕਸਾਨ ਕਰਦੇ ਹਨ ਚੂਹੇ ਵੀ ਆ ਕੇ ਫ਼ਸਲਾਂ ਤਬਾਹ ਕਰਦੇ ਹਨ ਅਤੇ ਉਸ ਦੇ ਵਿੱਚ ਖੱਡੇ ਬਣਾਉਂਦੇ ਹਨ ਜਿਹੜੇ ਕਿ ਫ਼ਸਲਾਂ ਦੀ ਪੈਦਾਵਰ ਨੂੰ ਘੱਟ ਕਰਦੇ ਹਨ ਅਤੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਹੋਰ ਕਈ ਕਈ ਕੁਝ ਲੋਕ ਫਸਲਾਂ ਤੋਂ ਰਾਖੀ ਲਈ ਪਹਿਰਾ ਵੀ ਲਗਾਉਂਦੇ ਹਨ ਅਤੇ ਉੱਥੇ ਰਾ ਰਹਿਣ ਦਾ ਇੰਤਜ਼ਾਮ ਵੀ ਕਰਦੇ ਹਨ ਅਤੇ ਕੋਸ਼ਿਸ਼ ਕਰਦੇ ਹਨ ਕਿ ਪਸ਼ੂਆਂ ਤੋਂ ਘੱਟ ਤੋਂ ਘੱਟ ਨੁਕਸਾਨ ਫ਼ਸਲਾਂ ਨੂੰ ਹੋ ਸਕੇ ਅਤੇ ਉਪਰਾਲਾ ਕੀਤਾ ਜਾਂਦਾ ਹੈ ਕਿ ਜਾਨਵਰਾਂ ਨੂੰ ਨੁਕਸਾਨ ਕਰੇ ਬਿਨਾਂ ਫਸਲਾਂ ਦੀ ਰਾਖੀ ਕੀਤੀ ਜਾਵੇ